ਅਸੀਂ ਸਫ਼ਰ ਕੀਤਾ ਸੀ ਮਾਛੀਵਾੜੇ ਦਾ ਬੱਸ ਦੀਆਂ ਸੀਟਾਂ ਸਭ ਟੁੱਟੀਆਂ ਹੋਈਆਂ ਸੀ ਅਤੇ ਸਾਡੇ ਅੱਗੇ ਇੱਕ ਸੀਟ ਖਾਲੀ ਪਈ ਸੀ ਉਹ ਤਾਂ ਸੀਟ ਹੀ ਨਿੱਚੇ ਡਿੱਗੀ ਜਾ ਰਹੀ ਸੀ ਅਤੇ ਉਸ ਤੋਂ ਬਾਅਦ ਬੱਸ ਅੱਗੇ ਜਾ ਕੇ ਖਰਾਬ ਹੋ ਗਈ ਅਤੇ ਡਰਾਈਵਰ ਨੇ ਬੱਸ ਖੜ੍ਹੀ ਕਰਕੇ ਆਪ ਹੀ ਠੀਕ ਕਰਦਾ ਰਿਹਾ ਅਤੇ ਅਸੀਂ ਗਰਮੀ ਵਿੱਚ ਪਰੇਸ਼ਾਨ ਹੋਏ